ਸਰ ਮੈਂ ਨਾ ਇੱਕ ਸਮਾਰਟ ਵਾਚ ਦੇਖੀ ਸੀ ਤੁਹਾਡੀ ਐਮਾਜ਼ੋਨ ਵੈਬਸਾਈਟ 'ਤੇ ਅਤੇ ਮੈਂ ਇਹਨੂੰ ਆਨਲਾਈਨ ਆਰਡਰ ਤਾਂ ਕਰਨਾ ਚਾਹੁੰਦੀ ਹਾਂ ਪਰ ਜਦੋਂ ਮੈਂ ਦੇਖ ਰਹੀ ਹਾਂ ਤਾਂ ਇਹਦੀ ਜਿਹੜੀ ਡਿਲੀਵਰੀ ਡੇਟ ਦਿਖਾ ਰਿਹਾ ਇਹ ਥੋੜ੍ਹੀ ਜਿਹੀ ਅੱਗੇ ਦਿਖਾ ਰਿਹਾ ਅਤੇ ਮੈਨੂੰ ਥੋੜ੍ਹਾ ਜਿਹਾ ਪਹਿਲਾਂ ਚਾਹੀਦੀ ਇਹ ਅਤੇ ਮੈਂ ਤੁਹਾਨੂੰ ਇੱਕ ਪੁੱਛਣਾ ਚਾਹੂੰਗੀ ਕਿ ਕੀ ਤੁਸੀਂ ਇਹਦੀ ਜਿਹੜੀ ਡੇਟ ਹੈਗੀ ਹੈ ਇਹ ਮੈਨੂੰ ਵੀਹ ਮਾਰਚ ਦਿਖਾ ਰਿਹਾ ਅਤੇ ਇਹ ਮੈਨੂੰ ਥੋੜ੍ਹੀ ਹਫਤਾ ਕੁ ਰਹਿੰਦਾ ਇਹਦੇ ਵਿੱਚ ਅਤੇ ਮੈਨੂੰ ਉਹ ਦੋ ਦਿਨ ਬਾਅਦ ਡਲੀਵਰ ਹੋ ਸਕਦੀ ਹੈ ਕਿਉਂਕਿ ਇਹ ਜਿਹੜੀ ਵਾਚ ਹੈ ਨਾ ਅਤੇ ਇਹ ਆਪਣੇ ਮੈਂ ਬੇਟੇ ਨੂੰ ਗਿਫਟ ਕਰਨੀ ਹੈ ਉਹਦਾ ਬਰਥਡੇ ਹੈਗਾ ਆ ਸੌਲਾਂ ਮਾਰਚ ਨੂੰ ਅਤੇ ਮੈਂ ਚਾਹੁੰਦੀ ਹਾਂ ਕਿ ਮੈਨੂੰ ਇਹ ਤੁਸੀਂ ਦੋ ਦਿਨਾਂ 'ਚ ਡਿਲੀਵਰ ਕਰ ਦੋ ਇਨ ਕੇਸ ਜੇ ਕੋਈ ਇਹਦੀ ਵਾਪਸੀ ਵੀ ਕਰਨੀ ਹੋਏਗੀ ਤਾਂ ਮੈਂ ਟਾਈਮਲੀ ਕਰ ਸਕਦੀ ਹਾਂ ਅਤੇ ਮੈਂ ਚਾਹੁੰਦੀ ਆ ਕਿ ਮੇਰੇ ਇਹਦਾ ਬੇਟੇ ਦਾ ਏਟੀਂਨਥ ਬਰਥਡੇ ਆ ਅਤੇ ਮੈਂ ਏਟੀਨਥ ਬਰਥਡੇ 'ਤੇ ਹੁਣ ਆਹ ਸਪੈਸ਼ਲ ਉਹਨੇ ਮੰਗੀ ਸੀ ਅਤੇ ਮੈਂ ਸਮਾਰਟ ਸਮਾਰਟ ਵਾਚ ਤੁਹਾਨੂੰ ਉਹਨੂੰ ਗਿਫਟ ਕਰਾਂ ਅਤੇ ਪਲੀਜ਼ ਮੈਨੂੰ ਤੁਸੀਂ ਇਹ ਪੁੱਛ ਕੇ ਦੱਸ ਦਿਓ ਕਿ ਤੁਸੀਂ ਇਹ ਮੈਨੂੰ ਦੋ ਦਿਨ ਬਾਅਦ ਡਿਲੀਵਰ ਕਰ ਸਕਦੇ ਹੋ ਅਤੇ ਮੇਰੀ ਰਿਕੁਐਸਟ ਹੀ ਹੋਏਗੀ ਕਿਉਂਕਿ ਐਮਜ਼ੋਨ ਇੱਕ ਅੱਛਾ ਵੈਬਸਾਈਟ ਹੈਗੀ ਹੈ ਅਤੇ ਜੇ ਤੁਸੀਂ ਫਾਸਟ ਡਿਲੀਵਰੀ 'ਚ ਮੈਂ ਪਾ ਕੇ ਦੇਖਿਆ ਸੀ ਪਰ ਫਾਸਟ ਡਿਲੀਵਰੀ 'ਚ ਮੈਨੂੰ ਐਟ ਲੀਸਟ ਉਹ ਥਰੀ ਟੂ ਫੌਰ ਡੇਅਸ ਦਾ ਕਹਿ ਰਹੈ ਹੈ ਅਤੇ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਆਪਣਾ ਆਨਲਾਈਨ ਤੁਹਾਡੇ ਨਾਲ ਇੱਕ ਗੱਲ ਕਰ ਲਵਾਂ ਤਾਂ ਸ਼ਾਇਦ ਤੁਸੀਂ ਮੈਨੂੰ ਕੋਈ ਇਹਦਾ ਵੇ ਆਊਟ ਦੱਸ ਦੋ ਅਤੇ ਜੇ ਤੁਸੀਂ ਮੈਨੂੰ ਇਹਦਾ ਵੇ ਆਊਟ ਕੋਈ ਹੋਰ ਦੱਸ ਦਉਗੇ ਤਾਂ ਮੈਂ ਆਪਣੇ ਬੇਟੇ ਦੀ ਜਿਹੜੀ ਹੈਗੀ ਨਾ ਇੱਕ ਸਰਪਰਾਈਜਿੰਗ ਲਈ ਉਹਨੂੰ ਮੈਂ ਗਿਫਟ ਦੇ ਦਉਂਗੀ ਅਤੇ ਪਲੀਜ਼ ਤੁਸੀਂ ਮੈਨੂੰ ਨਾ ਇਹਨੂੰ ਦੱਸੋ ਮੈਂ ਕਿੱਦਾਂ ਕਰਨਾ ਥੈਂਕ ਯੂ